ਹੈਲੋ ਸਤਿ ਸ਼੍ਰੀ ਅਕਾਲ ਕਿੱਦਾਂ ਤੁਹਾਡਾ ਕੀ ਹਾਲ ਚਾਲ ਬਸ ਸਬਜ਼ੀ ਧਰਨ ਲੱਗੀ ਸੀਗੀ ਦਾਲ ਬਣਾਉਣ ਲੱਗੀ ਸੀ ਉਹ ਹੀ ਕਰਦੀ ਪਈ ਤੁਸੀਂ ਦੱਸੋ ਅੱਛਾ ਬਹੁਤ ਬਹੁਤ ਵਧਾਈਆਂ ਤੁਹਾਨੂੰ ਅੱਛਾ ਕਿਥੋਂ ਦੀ ਆ ਕੁੜੀ ਫਿਰ ਅੱਛਾ ਚੰਗਾ ਤਾਂ ਕਦੋਂ ਦਾ ਵਾ ਫਿਰ ਅੱਛਾ ਵਧੀਆ ਬਹੁਤ ਵਧੀਆ ਪੂਰੇ ਪਰਿਵਾਰ ਨੂੰ ਬਹੁਤ ਵਧੀਆ ਤ ਵਧਾਈਆਂ ਸਾਰਿਆਂ ਨੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਕੱਲੇ ਦਾ ਮੁੰਡਾ ਥੋੜ੍ਹੀ ਆ ਸਾਡਾ ਵੀ ਤਾਂ ਮੁੰਡਾ ਹੀ ਆ ਹਾਂਜੀ ਅਤੇ ਕੀ ਨੇ ਤੁਸੀਂ ਪੂਰਾ ਦਾ ਘਰ ਰੈਨੋਵੇਟ ਕਰਾਉਣਾ ਜਾਂ ਜਿਹੜਾ ਤੁਹਾਡਾ ਉੱਪਰ ਵਾਲਾ ਹਿੱਸਾ ਵਾ ਤੁਸੀਂ ਉਹ ਉਹ 'ਤੇ ਨਵਾਂ ਕਮਰਾ ਬਣਵਾਉਣਾ ਆਹੋ ਬਾਹਰ ਵਾਲਿਆਂ ਦੇ ਤਾਂ ਆਪਣੇ ਹੁੰਦੇ ਆ ਮਨਪਸੰਦ ਦੀ ਚੀਜ਼ਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨੀਆਂ ਹੁੰਦੀਆਂ ਨਹੀਂ ਨਹੀਂ ਠੀਕ ਵਾ ਅਤੇ ਨਾਲੇ ਵਿਆਹ ਵਾ ਤੁਹਾਨੂੰ ਜੇ ਕਿਸੇ ਚੀਜ਼ ਦੀ ਲੋੜ ਪਵੇ ਸਾਹਮਣੇ ਤਾਂ ਰਹਿੰਦੇ ਅਸੀਂ ਤੁਹਾਡੇ ਆਰਾਮ ਨਾਲ ਆ ਕੇ ਜਦੋਂ ਕੋਈ ਲੋੜ ਹੋਈ ਸਾਨੂੰ ਉਦੋਂ ਹੀ ਆ ਕੇ ਦੱਸ ਦਿਓ

ਆਉਂਦੇ ਨਹੀਂ ਆ ਹਾਂ ਸਾਡੇ ਵੀ ਅਸੀਂ ਵੀ ਪਿਛਲੀ ਵਾਰ ਕਰਾਇਆ ਤਾਂ ਸੀ ਤੁਹਾਨੂੰ ਪਤਾ ਹੀ ਆ ਉਦੋਂ ਵੀ ਇੱਦਾਂ ਹੀ ਲਟਕਾਏ ਫਿਰਦਾ ਮਹੀਨੇ ਦਾ ਕੰਮ ਸੀ ਡੇਢ ਮਹੀਨੇ ਤੱਕ ਲੈ ਗਏ ਉਹ ਕੰਮ ਸਾਰਾ ਆਹੀ ਹਾਲ ਰਹਿੰਦਾ ਇਹਨਾਂ ਦਾ ਹਾਂਜੀ ਅਤੇ ਨਾਲੇ ਮੁੰਡਾ ਆ ਗਿਆ ਜਾਂ ਹਾਲੇ ਆਉਣਾ ਉਹਨੇ ਬਾਹਰੋਂ ਅੱਛਾ ਠੀਕ ਆ ਆਊਗਾ ਆਪੇ ਕਰਵਾ ਲਵੇਗਾ ਹਾਂਜੀ ਹਾਂਜੀ ਜ਼ਰੂਰ ਕੋਈ ਦਿੱਕਤ ਦੀ ਗੱਲ ਨਹੀਂ ਹੈਗੀ ਜੋ ਤੁਸੀਂ ਕਰਾਉਣਾ ਕਰਾਓ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚੰਗਾ ਹਾਂਜੀ ਚੰਗਾ ਫਿਰ ਸਤਿ ਸ਼੍ਰੀ ਅਕਾਲ ਜੀ